ਹੈਲੋ ਓਲਾ ਤੋਂ ਗੱਲ ਕਰਦੇ ਪਏ ਹੋ ਜੀ ਹਾਂਜੀ ਵੀਰ ਜੀ ਮੈਂ ਨਾ ਇੱਕ ਕੈਬ ਬੁੱਕ ਕਰਨੀ ਸੀਗੀ ਅਸੀਂ ਅੰਮ੍ਰਿਤਸਰ ਤੋਂ ਪੀ ਏ ਯੂ ਜਾਣਾ ਵਾ ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਣਾ ਵਾ ਅਸੀਂ ਤਿੰਨ ਜਾਣੇ ਹਾਂ ਅਸੀਂ ਸੱਤ ਤਰੀਕ ਨੂੰ ਜਾਣਾ ਵਾ ਸੰਡੇ ਨੂੰ ਅਤੇ ਉੱਥੇ ਸਾਡਾ ਪੇਪਰ ਹੈਗਾ ਵਾ ਅਤੇ ਹਾਂਜੀ ਹਾਂਜੀ ਸੱਤ ਸੰਡੇ ਨੂੰ ਪੇਪਰ ਹੈਗਾ ਵਾ ਗੋਰਮੈਂਟ ਜੋਬ ਦਾ ਪੇਪਰ ਹੈਗਾ ਵਾ ਅਤੇ ਉਹ ਸੰਡੇ ਨੂੰ ਹੁੰਦੇ ਆ ਛੁੱਟੀ ਵਾਲੇ ਦਿਨ ਹੁੰਦੇ ਨਾ ਯੂਨੀਵਰਸਿਟੀ ਵਗੈਰਾ ਛੁੱਟੀ ਵਗੈਰਾ ਹੁੰਦੀ ਆ ਅਤੇ ਉਹਦੇ ਕਰਕੇ ਸਾਡਾ ਪੇਪਰ ਇੱਕ ਵਜੇ ਸਟਾਰਟ ਹੋਣਾ ਵਾ ਅਤੇ ਚਾਰ ਕੁ ਵਜੇ ਖਤਮ ਹੋਏਗਾ ਅਤੇ ਤੁਸੀਂ ਕਿੰਨੇ ਕੁ ਵਜੇ ਸਾਨੂੰ ਬੰਦਾ ਭੇਜ ਦੋਗੇ ਸਾਡੇ ਕੋਲ ਪਿਕਅੱਪ ਲਈ ਨੌ ਵਜੇ ਚਲੋ ਨੌ ਵਜੇ ਠੀਕ ਆ ਅਤੇ ਨੌ ਵਜੇ ਤੁਸੀਂ ਬੰਦਾ ਭੇਜ ਦਿਓ ਐਡਰੈੱਸ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ ਜਦੋਂ ਤੁਸੀਂ ਆ ਮੇਨ ਗ੍ਰੈਂਡ ਟਨਕ ਰੋਡ ਤੋਂ ਯੂਨੀਵਰਸਿਟੀ ਕਰੋਸ ਕਰੋਗੇ ਤਾਂ ਯੂਨੀਵਰਸਿਟੀ ਤੋਂ ਅਗਲੇ ਸਾਈਡ ਆ ਕੇ ਤੁਹਾਡੇ ਰਾਈਟ ਹੈਂਡ ਸਾਈਡ ਟਰਨ ਆਏਗਾ ਇੱਕ ਉਹ ਰਾਈਟ ਹੈਂਡ ਸਾਈਡ ਟਰਨ ਲੈ ਲਿਓ ਅਤੇ ਉਸ ਤੋਂ ਅੱਗੇ ਲਾਸਟ 'ਤੇ ਆ ਕੇ ਇੱਕ ਲੈਫਟ ਹੈਂਡ ਸਾਈਡ ਟਰਨ ਆਏਗਾ ਅਤੇ ਲੈਫਟ ਹੈਂਡ ਸਾਈਡ ਟਰਨ ਲੈ ਲਿਓ ਅਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਅਤੇ ਦਸ ਪੰਦਰਾਂ ਮੀਟਰ ਅੱਗੇ ਜਾ ਕੇ ਅਤੇ ਤੁਹਾਨੂੰ ਇੱਕ ਸੱਜੇ ਹੱਥ ਵਾਲੇ ਬੰਨੇ ਆਈ ਕਿ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਮ੍ਰਿਤਸਰ ਕੈਂਪਸ ਦਾ ਇੱਕ ਬੋਰਡ ਨਜ਼ਰ ਆਏਗਾ ਅਤੇ ਉਹਦੇ ਬਿਲਕੁਲ ਸਾਹਮਣੇ ਤਿੰਨ ਸੌ ਚੌਬੀ ਨੰਬਰ ਸਾਡਾ ਘਰ ਹੈਗਾ ਵਾ ਅਤੇ ਤੁਸੀਂ ਸਾਨੂੰ ਉੱਥੋਂ ਡਰੋਪ ਕਰ ਲਿਓ ਅਤੇ ਨਾਲ ਇੱਕ ਗੱਲ ਹੋਰ ਕਿ ਡਰਾਈਵਰ ਜਿਹੜਾ ਕੋਈ ਵਧੀਆ ਭੇਜਿਓ ਤੁਸੀਂ ਪਿਛਲੀ ਵਾਰੀ ਇੱਕ ਡਰਾਈਵਰ ਭੇਜਿਆ ਸੀਗਾ ਉਹ ਬਹੁਤ ਰੈਸ਼ ਡਰਾਈਵਿੰਗ ਕਰਦਾ ਹੈਗਾ ਵਾ ਅਤੇ ਸਾਨੂੰ ਰੈਸ਼ ਡਰਾਈਵਿੰਗ ਇੰਨੀ ਵਧੀਆ ਨਹੀਂ ਲੱਗਦੀ ਕੋਈ ਹੁਣ ਧੁੰਦ ਧੰਦ ਦਾ ਵੀ ਸੀਜਨ ਹੈਗਾ ਵਾ ਅਤੇ ਕਿਤੇ ਐਕਸੀਡੈਂਟ ਵਗੈਰਾ ਕੁਛ ਇੱਦਾਂ ਦਾ ਕੁਛ ਮਿਸਹੈਪਿੰਗ ਨਾ ਹੋਵੇ ਸਾਡੇ ਨਾਲ ਅਤੇ ਗੱਡੀ ਵੀ ਕਲੀਨ ਵਗੈਰਾ ਹੋਵੇ ਅਤੇ ਸਮੈੱਲ ਵਗੈਰਾ ਨਾ ਆਉਂਦੀ ਹੋਵੇ ਇਹਦੇ ਵਿੱਚੋਂ ਧਵਾ ਕੇ ਤਾਂ ਫਿਰ ਗੱਡੀ ਵਗੈਰਾ ਭੇਜਿਓ ਕੋਈ ਵੀ ਅਤੇ ਨਾਲੇ ਇੱਕ ਉਹ ਚੀਜ਼ ਹੋਰ ਮੈਂ ਭੁੱਲ ਗਿਆ ਸੀਗਾ ਕਿ ਠੰਡ ਹੈਗੀ ਆ ਅਤੇ ਠੰਡ ਦੇ ਵਿੱਚ ਥੋੜ੍ਹਾ ਹੀਟਰ ਵਗੈਰਾ ਦਿਆ ਕਰੋ ਗੱਡੀ ਵਿੱਚ ਕੋਈ ਸੁਵਿਧਾ ਉਹ ਮਿਲੇ ਸਾਨੂੰ ਤਾਂ ਜ਼ਿਆਦਾ ਬੈਟਰ ਹੋਏਗਾ ਕਿਉਂਕਿ ਠੰਡ ਵਿੱਚ ਮੁੜ ਕੇ ਹੱਥ ਪੈਰ ਵੀ ਕੰਮ ਨਹੀਂ ਕਰਦੇ ਤੁਹਾਨੂੰ ਪਤਾ ਗੱਡੀ ਤੇਜ਼ ਚੱਲਦੀ ਹੈ ਅਤੇ ਠੀਕ ਹੈ ਮਿਲ ਜਾਏਗਾ ਠੀਕ ਆ ਠੀਕ ਆ ਭਾਅ ਜੀ ਨੌ ਵਜੇ ਤੁਸੀਂ ਭੇਜ ਦਿਓ ਧੰਨਵਾਦ